ਇਸ ਖੇਤਰ ਵਿੱਚ ਬਹੁਤ ਸਾਰੇ ਲੋਕ ਗੀਤ ਹਨ ਜਿਵੇਂ ਕਿ ਸੁਹਾਗ ਘੋੜੀਆਂ ਟੱਪੇ ਮਾਹੀਏ ਬੋਲੀਆਂ ਸਿੱਠਣੀਆਂ ਅਤੇ ਢੋਲੇ ਬੁਝਾਰਤਾਂ ਬੋਲੀਆਂ ਆਦਿ ਅਤੇ ਸੁਹਾਗ ਜਿਹੜੇ ਨੇ ਉਹ ਕੁੜੀਆਂ ਦੇ ਵਿਆਹ ਦੇ ਮੌਕੇ 'ਤੇ ਗਾਏ ਜਾਂਦੇ ਕੁਝ ਦਿਨ ਪਹਿਲਾਂ ਅਤੇ ਘੋੜੀਆਂ ਜਿਹੜੀਆਂ ਨੇ ਉਹ ਮੁੰਡੇ ਦੇ ਵਿਆਹ ਦੇ ਮੌਕੇ 'ਤੇ ਗਾਏ ਜਾਂਦੇ ਨੇ ਅਤੇ ਜਿਹੜੀਆਂ ਸਿਠਣੀਆਂ ਨੇ ਉਹ ਜਦੋਂ ਜਾਂਝੀ ਬਰਾਤ ਲੈ ਕੇ ਆਉਂਦੇ ਨੇ ਤਾਂ ਉਦੋਂ ਮੇਲਣਾ ਦੁਆਰਾ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਅਤੇ ਜਿਹੜੀਆਂ ਬੋਲੀਆਂ ਅਤੇ ਟੱਪੇ ਨੇ ਉਹ ਕੁੜੀਆਂ ਪਾ ਕੇ ਅਤੇ ਉਹਨਾਂ ਨੂੰ ਨੱਚਦੀਆਂ ਨੇ ਅਤੇ ਉਸ ਤੋਂ ਬਾਅਦ ਬੁਝਾਰਤਾਂ ਜਿਹੜੀਆਂ ਵਾ ਇਹ ਦਿਮਾਗੀ ਸਵਾਲ ਹੁੰਦੇ ਨੇ ਜਿਹੜੀਆਂ ਬੁੱਝਣੀਆਂ ਹੁੰਦੀਆਂ ਨੇ ਅਤੇ ਜਿਹੜੇ ਢੋਲੇ ਨੇ ਉਹ ਪੱਛਮੀ ਪੰਜਾਬ ਦੇ ਨੇ ਜ਼ਿਆਦਾਤਰ ਉਸ ਉਹਨਾਂ ਨੂੰ ਲੋਕ ਪੱਛਮੀ ਭਾਸ਼ਾ ਦੇ ਵਿੱਚ ਲਿਖੇ ਗਏ ਹਨ ਅਤੇ ਉਹ ਪੱਛਮੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਉਹਨਾਂ ਨੂੰ ਗਾਉਂਦੇ ਨੇ ਅਤੇ ਇਸ ਤਰ੍ਹਾਂ ਇਹ ਸਾਰੇ ਜਿਹੜੇ ਲੋਕ ਗੀਤ ਨੇ ਇਹਨਾਂ ਦੇ ਵੱਖ ਵੱਖ ਰੂਪ ਹਨ